ਸਤਿ ਸ਼੍ਰੀ ਅਕਾਲ ਮੈਨੂੰ ਲੈਨੋਵੋ ਕੰਪਨੀ ਦਾ ਇੱਕ ਲੈੱਪਟੋਪ ਖਰੀਦਣਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਲੈਪਟੋਪ ਦੀ ਸਟੋਰੇਜ ਸੀ ਪੀ ਯੂ ਗ੍ਰਾਫਿਕਸ ਕਾਰਡ ਡਿਸਪਲੇ ਸਾਈਜ਼ ਰੈਫੀ ਰੈਜ਼ੀਲਯੂਸ਼ਨ ਕਨੈਕਟਿਵਿਟੀ ਅਤੇ ਵਿਸ਼ੇਸ਼ਤਾਵਾਂ ਕਿਸ ਤਰ੍ਹਾਂ ਦੀਆਂ ਹਨ ਓਪਰੇਟਿੰਗ ਸਿਸਟਮ ਪ੍ਰੋਸੈਸਰ ਰੈਮ ਬੈਟਰੀ ਲਾਈਫ ਕੀਬੋਰਡ ਟੈਕਸਟਪੈਡ ਅਤੇ ਪੋਰਟੇਬਿਲਟੀ ਬਾਰੇ ਵੀ ਜਾਣਕਰੀ ਦਿਓ ਜੇ ਮੈਂ ਇਹ ਲੈਪਟੋਪ ਈ ਐੱਮ ਆਈ 'ਤੇ ਖਰੀਦਾਂ ਤਾਂ ਮੈਨੂੰ ਕਿਸ ਕੀਮਤ 'ਤੇ ਮਿਲੇਗਾ ਜਾਂ ਫਿਰ ਔਨਲਾਈਨ ਕੈਸ਼ ਦੇ ਜ਼ਰੀਏ ਖਰੀਦਾਂ ਤਾਂ ਮੈਨੂੰ ਇਹ ਲੈਪਟੋਪ ਕਿਸ ਕੀਮਤ ਉੱਤੇ ਮਿਲੇਗਾ